ਹਾਂਜੀ ਜੀ ਮੈਂ ਇੱਕ ਆਪਣਾ ਸੂਟ ਬਣਾਇਆ ਸੀ ਸਿਲਾਈ ਕੀਤਾ ਸੀ ਜੋ ਕਿ ਮੈਨੂੰ ਵਧੀਆ ਲੱਗਿਆ ਅਤੇ ਮੈਂ ਆਪਣੇ ਇਹ ਆਂਢ ਗੁਆਂਢ ਵਿੱਚ ਵੀ ਦਿਖਾਇਆ ਕਿ ਉਹ ਸੂਟ ਉਹਨਾਂ ਨੂੰ ਵੀ ਵਧੀਆ ਲੱਗਿਆ ਅਤੇ ਉਹਨਾਂ ਨੂੰ ਬੜਾ ਵਧੀਆ ਲੱਗਿਆ ਕਿ ਇਹ ਸੂਟ ਤੁਸੀਂ ਬਣਾਇਆ ਹੈ ਅਤੇ ਮੈਨੂੰ ਸਿਲਾਈ ਕਢਾਈ ਦਾ ਥੋੜ੍ਹਾ ਜਿਹਾ ਸ਼ੌਕ ਸੀ ਅਤੇ ਮੈਂ ਇੱਕ ਵਾਰ ਆਪਣੇ ਵੱਲੋਂ ਬਣਾ ਕੇ ਦੇਖਿਆ ਪਰ ਵਧੀਆ ਬਣਿਆ ਸੀ ਅਤੇ ਮ ਮੈਨੂੰ ਆਪਣੇ ਆਪ 'ਤੇ ਮਾਣ ਹੋਇਆ ਕਿ ਮੈਂ ਇਹ ਕੰਮ ਕਰ ਸਕਦੀ ਹਾਂ ਅਤੇ ਫਿਰ ਮੇਰੇ ਇੱਕ ਗੁਆਂਢੀ ਨੇ ਮੈਨੂੰ ਸੂਟ ਦਿੱਤਾ ਜੋ ਕਿ ਮੈਂ ਸ ਸਿਲਾਈ ਕੀਤਾ ਉਸ ਨੂੰ ਵੀ ਬਹੁਤ ਵਧੀਆ ਲੱਗਿਆ ਅਤੇ ਇਹ ਇਹ ਹੁਨਰ ਮੇਰੇ ਵਿੱਚ ਸੀ ਮੈਨੂੰ ਬਹੁਤ ਵਧੀਆ ਲੱਗਿਆ